ਮੈਂ ਆਪਣੇ ਕੈਮਰੇ ਨਾਲ ਵੱਖੋ ਵੱਖਰੀਆਂ ਬਹੁਤ ਸੋਹਣੀਆਂ ਸੋਹਣੀਆਂ ਜਿਹੜੀਆਂ ਵਾਂ ਤਸਵੀਰਾਂ ਖਿੱਚਦੀ ਹਾਂ ਜਿਵੇਂ ਕਿ ਜਦੋਂ ਵੀ ਕੋਈ ਵੀ ਵਧੀਆ ਮੌਸਮ ਹੋਇਆ ਹੋਵੇ ਉਦੋਂ ਵੀ ਮੈਂ ਤਸਵੀਰਾਂ ਖਿੱਚਦੀ ਉਸ ਮੌਸਮ ਦੀਆਂ ਨਾਲ ਦੇ ਨਾਲ ਜਦੋਂ ਸ਼ਾਮ ਦੇ ਵੇਲੇ ਸੂਰਜ ਜਦੋਂ ਢਲਦਾ ਹੈ ਤਾਂ ਆਸੇ ਪਾਸੇ ਦਾ ਮੌਸਮ ਬਹੁਤ ਹੀ ਸੋਹਣਾ ਹੋ ਜਾਂਦਾ ਹੈ ਹਰ ਪਾਸੇ ਜੋ ਹਰਿਆਲੀ ਹੁੰਦੀ ਆ ਉਹ ਬਹੁਤ ਹੀ ਸੋਹਣੀ ਲੱਗਦੀ ਆ ਉਹਦੀ ਤਸਵੀਰ ਖਿੱਚਦੀ ਹਾਂ ਇਸ ਤੋਂ ਇਲਾਵਾ ਜੋ ਸਾਡੇ ਘਰ ਲਾਗੇ ਵੱਖੋ ਵੱਖਰੇ ਤਰੀਕੇ ਦੇ ਫੁੱਲ ਹੈਗੇ ਆ ਰੰਗ ਬਿਰੰਗੇ ਜੋ ਫੁੱਲ ਆ ਉਹਨਾਂ ਦੀਆਂ ਤਸਵੀਰਾਂ ਖਿੱਚਦੀ ਹਾਂ ਉਹ ਬਹੁਤ ਹੀ ਸੋਹਣੇ ਲੱਗਦੇ ਆ ਇਸ ਤੋਂ ਇਲਾਵਾ ਜੋ ਵੀ ਪੰਛੀ ਜਾਂ ਜੋ ਵੀ ਮਤਲਬ ਵਧੀਆ ਵਧੀਆ ਚੀਜ਼ਾਂ ਹੁੰਦੀਆਂ ਆਸੇ ਪਾਸੇ ਉਹਨਾਂ ਦੀ ਤਸਵੀਰਾਂ ਖਿੱਚਦੀ ਹਾਂ ਹਰ ਇੱਕ ਚੀਜ਼ ਜਿਹੜੀ ਉਹ ਬਹੁਤ ਹੀ ਸੋਹਣੀ ਲੱਗਦੀ ਆ ਇੱਥੇ ਅਸੀਂ ਜਿਸ ਤਰ੍ਹਾਂ ਪਿੰਡ ਵਿੱਚ ਰਹਿੰਦੇ ਹਾਂ ਅਤੇ ਆਸੇ ਪਾਸੇ ਹਰਿਆਲੀ ਹੁੰਦੀ ਆ ਤਾਂ ਉਹ ਹਰਿਆਲੀ ਜਦੋਂ ਹੁੰਦੀ ਤਾਂ ਉਹਨੂੰ ਜਦੋਂ ਆਪਾਂ ਫੋਟੋ ਵਿੱਚ ਖਿੱਚਦੇ ਤਾਂ ਹੋਰ ਵੀ ਸੋਹਣੀ ਲੱਗਦੀ ਹੈ ਇਸ ਤਰੀਕੇ ਨਾਲ ਕੀ ਆ ਕਿ ਮੈਂ ਵਧੀਆ ਵਧੀਆ ਫੋਟੋਆਂ ਜਿਹੜੀਆਂ ਵਾ ਆਪਣੇ ਕੈਮਰੇ ਨਾਲ ਖਿੱਚਦੀ ਹਾਂ